ਹਾਂਜੀ ਭਾਈ ਸਾਹਿਬ ਤੁਸੀਂ ਬੜੀ ਮਿਹਰਬਾਨੀ ਤੁਹਾਡੀ ਤੁਸੀਂ ਮੈਨੂੰ ਮੇਰੇ ਦਿੱਤੇ ਹੋਏ ਸਟੇਸ਼ਨ 'ਤੇ ਦੱਸੇ ਹੋਏ ਸਟੇਸ਼ਨ 'ਤੇ ਪਹੁੰਚਾ ਦਿੱਤਾ ਔਰ ਮੈਨੂੰ ਥੋੜ੍ਹਾ ਹੈਰਾਨੀ ਵੀ ਆ ਔਰ ਪਰੇਸ਼ਾਨ ਵੀ ਹਾਂ ਕਿ ਮੇਰਾ ਜਿਹੜਾ ਪੈਸਿਆਂ ਵਾਲਾ ਪਰਸ ਆ ਓਹ ਘਰ ਭੁੱਲ ਗਿਆ ਇਸ ਵੇਲੇ ਮੇਰੇ ਕੋਲ ਪੈਸੇ ਨਹੀਂ ਪਰ ਕੋਈ ਨਹੀਂ ਘਬਰਾਓ ਨਾ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੀ ਪੀ ਆਈ ਆਈ ਡੀ ਦੱਸੋ ਜਾਂ ਫੋਨ ਪੇਅ ਮੈਨੂੰ ਦੱਸ ਦਿਓ ਉਹਦੇ ਰਾਹੀਂ ਤੁਹਾਨੂੰ ਮੈਂ ਔਨਲਾਈਨ ਭੁਗਤਾਨ ਕਰਦਾਂ ਕੋਈ ਨਹੀਂ ਘਬਰਾਓ ਨਾ ਤੁਸੀਂ ਤੁਹਾਡੇ ਜਿੰਨੇ ਪੈਸੇ ਹੈ ਤੁਹਾਡੇ ਕੋਲ ਓ ਗੱਡੀ ਦੇ ਵਿੱਚ ਸਕੈਨਰ ਲੱਗਿਆ ਹੋਣਾ ਉਹ ਮੈਨੂੰ ਦੇ ਦਿਓ ਮੈਂ ਉਹਦੇ 'ਤੇ ਭੁਗਤਾਨ ਕਰ ਸਕਦਾਂ